ਹਾਂਜੀ ਮੈਨੂੰ ਕਿਤਾਬਾਂ ਲਿਖਣ ਦਾ ਬਹੁਤ ਸ਼ੌਂਕ ਆ ਅਤੇ ਮੇਰੀ ਇਹ ਰੂਟੀਨ ਇਹ ਬਣ ਗਈ ਕਿ ਮੈਂ ਰਾਤ ਨੂੰ ਆਪਣਾ ਫਰੀ ਟਾਈਮ 'ਚ ਕੁਛ ਨਾ ਕੁਛ ਜ਼ਰੂਰ ਲਿਖਦਾ ਅਤੇ ਜਦੋਂ ਵੀ ਮੈਨੂੰ ਵਿਹਲਾ ਟਾਈਮ ਮਿਲਦਾ ਅਤੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹਦੇ 'ਚ ਮੈਂ ਕੁਛ ਨਾ ਕੁਛ ਲਿਖਣਾ ਜ਼ਰੂਰ ਹੁੰਦਾ ਅਤੇ ਅਤੇ ਮੈਨੂੰ ਜਿਵੇਂ ਆਪਣਾ ਲੋਕ ਆਪਣੇ ਕੰਮ ਤੋਂ ਦੂਰ ਹੋ ਰਹੇ ਨੇ ਆਪਣੇ ਫੋਨਾਂ 'ਚ ਵੜ ਰਹੇ ਆ ਜਾਂ ਰਿਸ਼ਤਿਆਂ ਤੋਂ ਦੂਰ ਹੋ ਰਹੇ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸਲ ਹੁੰਦੀਆਂ ਨੇ ਉਹ ਚੀਜ਼ਾਂ ਮੈਨੂੰ ਲਿਖਣੀਆਂ ਬਾਕੀ ਬਾਹਲੀਆਂ ਪਸੰਦ ਨੇ ਅਤੇ ਉਹ ਚੀਜ਼ਾਂ ਲਿਖਣ ਦੀ ਮੈਂ ਕੋਸ਼ਿਸ਼ ਜ਼ਰੂਰ ਕਰਦਾ ਹੁੰਦਾ ਅਤੇ ਬਾਕੀ ਇਨ ਫਿਊਚਰ ਜੇ ਮੈਨੂੰ ਟਾਈਮ ਮਿਲਦਾ ਜਾਂ ਜੇ ਮੈਨੂੰ ਮੌਕਾ ਮਿਲਦਾ ਵੀ ਹਾਂ ਇਨ ਫਿਊਚਰ ਮੈਂ ਆਪਣੀ ਕਿਤਾਬ ਨੂੰ ਪਬਲਿਸ਼ ਕਰੂੰਗਾ ਅਤੇ ਮੈਂ ਜ਼ਰੂਰ ਉਹ ਕਿਤਾਬ ਨੂੰ ਆਪਣੇ ਪਬਲਿਸ਼ ਕਰਕੇ ਲੋਕਾਂ ਦੇ ਰੂਬਰੂ ਰੱਖੂੰਗਾ ਤਾਂ ਕਿ ਲੋਕਾਂ ਨੂੰ ਮੈਨੂੰ ਪਤਾ ਲੱਗ ਸਕੇ ਜੋ ਮੈਂ ਲਿਖਿਆ ਏ ਉਹ ਚੀਜ਼ ਠੀਕ ਲਿਖੀ ਆ ਜਾਂ ਨਹੀਂ ਸਹੀ ਲਿਖੀ